ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਸਭ ਨੂੰ ਇੱਕ ਪ੍ਰੋਡਕਟ ਬਾਰੇ ਦੱਸਣਾ ਚਾਹੁੰਦੀ ਹਾਂ ਜੋ ਕਿ ਮੈਂ ਇੱਕ ਮੰਨਥ ਪਹਿਲੇ ਹੀ ਲਿਆ ਸੀ ਉਹਦੇ ਨਾਲ ਮੇਰੇ ਫੇਸ 'ਤੇ ਬਹੁਤ ਜ਼ਿਆਦਾ ਪਿੰਪਲ ਹੋ ਗਏ ਉਹ ਪਿੰਪਲ ਹੋਣ ਦੇ ਨਾਲ ਮੈਨੂੰ ਇਚਿੰਗ ਹੁੰਦੀ ਸੀ ਉਹ ਬਹੁਤ ਘਟੀਆ ਪ੍ਰੋਡਕਟ ਸੀ ਔਰ ਜਿੱਥੇ ਤੱਕ ਮੈਨੂੰ ਲੱਗਦਾ ਕਿ ਸਾਨੂੰ ਇੱਦਾਂ ਦੇ ਪ੍ਰੋਡਕਟ ਨਹੀਂ ਲੈਣੇ ਚਾਹੀਦੇ ਜਿਹੜੇ ਸਾਡੇ ਫੇਸ 'ਤੇ ਰਿਐਕਟ ਕਰਦੇ ਆ ਕਿਉਂਕਿ ਆਪਾਂ ਸਾਰੇ ਲੋਕ ਦੇਖਦੇ ਹਾਂ ਬਹਾ ਬਾਹਰੀ ਸੁੰਦਰਤਾ ਦੇਖਣੀ ਆਪਾਂ ਸਾਰੇ ਤਾਂ ਪ੍ਰੋਡਕਟ ਜਿ ਜਿੱਦਾਂ ਜਿੱਦਾਂ ਆਪਾਂ ਗਲਤ ਪ੍ਰੋਡਕਟ ਲਵਾਂਗੇ ਸਾਨੂੰ ਆਪਣੀ ਸਕਿੰਨ ਟਾਈਮ ਦੇ ਅਕੋਡਿੰਗ ਪਤਾ ਹੀ ਨਹੀਂ ਹੈਗੀ ਸਾਨੂੰ ਕਿਹੜੇ ਪ੍ਰੋਡਕਟ ਲੈਣੇ ਚਾਹੀਦੇ ਆ ਕਿਹੜੇ ਪ੍ਰੋਡਕਟ ਨਹੀਂ ਲੈਣੇ ਚਾਹੀਦੇ ਜਿਸ ਕਾਰਨ ਬਾਅਦ 'ਚੋਂ ਸਾਨੂੰ ਬਹੁਤ ਪਛਤਾਵਾ ਹੁੰਦਾ ਕਿ ਸਾਨੂੰ ਇਹ ਪ੍ਰੋਡਕਟ ਯੂਜ ਨਹੀਂ ਕਰਨੇ ਚਾਹੀਦੇ ਸੀ ਜਿਹਦੇ ਨਾਲ ਸਾਡਾ ਫੇਸ ਖਰਾਬ ਹੋਇਆ ਔਰ ਫੇਸ ਸਾਡੇ ਸਰੀਰ ਦਾ ਬਹੁਤ ਇੰਪੋਰਟੈਂਟ ਅੰਗ ਹੈ ਹੈ ਨਾ ਜੋ ਕਿ ਜੋ ਕਿ ਸਾਡੀ ਬਾਹਰ ਦੀ ਖੂਬਸੂਰਤੀ ਨੂੰ ਦੱਸਦਾ ਇਸ ਕਰਕੇ ਮੈਨੂੰ ਲੱਗਦਾ ਕਿ ਮੇਰੇ ਬਹੁਤ ਜ਼ਿਆਦਾ ਤੋਂ ਜ਼ਿਆਦਾ ਫੇਸ ਕਰੀਮ ਯੂਜ ਕਰਨਾ ਇੱਕ ਪਰਟੀਕੁਲਰ ਫੇਸ ਕਰੀਮ ਰੱਖਣੀ ਚਾਹੀਦੀ ਕਿ ਆਪਾਂ ਇਹ ਲਾਉਣੀ ਆ ਜੇ ਜਿਹੜੇ ਸਾਰੇ ਕੈਮੀਕਲਜ ਵਗੈਰਾ ਤੋਂ ਦੂਰ ਹੋਵੇ ਇਸ ਕਰਕੇ ਮੈਂ ਤੁਹਾਨੂੰ ਬਸ ਇਹੀ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਜਿਹੜੇ ਤੁਸੀਂ ਪ੍ਰੋਡਕਟ ਯੂਜ ਕਰਦੇ ਹੋ ਉਹ ਪ੍ਰੋਡਕਟ ਵਧੀਆ ਆਯੁਰਵੈਦਿਕ ਪ੍ਰੋਡਕਟ ਹੋਣੇ ਚਾਹੀਦੇ ਆ ਇੱਦਾਂ ਲਿੰਗਡ ਪਿੰਗਡ ਯੂਜ ਕਰਕੇ ਤੁਹਾਡੇ ਮੂੰਹ ਖਰਾਬ ਹੋ ਜਾਵੇ ਤਾਂ ਉਹਦਾ ਵੀ ਕੀ ਫਾਇਦਾ ਧੰਨਵਾਦ